ਇਸ ਖੇਤਰ ਵਿੱਚ ਕੋਈ ਵੀ ਕੁਦਰਤੀ ਸਰੋਤ ਨਹੀਂ ਹੈ ਜੋ ਕਿ ਵਰਗ ਕਿਸੇ ਵੀ ਗਤੀਵਿਧੀ ਜਾਂ ਕੰਮ ਲਈ ਵਰਤੇ ਜਾ ਸਕਦੇ ਹਨ